ਵਰਤਮਾਨ ਵਿੱਚ ਲੋਕ ਕਲਾ ਸ਼ ਸ਼ਿਲਪਕਾਰੀ ਜਾਂ ਹੁਨਰ ਅਧਾਰਿਤ ਕਿੱਤੇ ਹਾਲੇ ਵੀ ਵੇਖਣ ਨੂੰ ਮਿਲਦੇ ਆ ਪਰ ਪੁਰਾਤਨ ਸਮਿਆਂ ਵਾਂਗ ਉਹ ਕਿੱਤੇ ਸਾਨੂੰ ਨਹੀਂ ਵੇਖਣ ਨੂੰ ਮਿਲਦੇ ਵਰਤਮਾਨ ਵਿੱਚ ਮੰਡੀਕਰਨ ਬਜ਼ਾਰ ਅਤੇ ਆਧੁਨਿਕ ਵਸਤੂਆਂ ਨੇ ਇਹਨਾਂ ਕਿਰਤੀਆਂ ਦਾ ਹੱਕ ਖੋਹ ਲਿਆ ਅਤੇ ਮਿੱਟੀ ਦੇ ਭਾਂਡਿਆਂ ਦੀ ਥਾਂ ਜਿਵੇਂ ਤੌੜਾ ਅਲ ਅੱਜ ਵੀ ਕੋਈ ਵਿਰਲਾ ਵਿਰਲਾ ਹੀ ਵਰਤਿਆ ਜਾਂਦਾ ਹੈ ਤੌੜੇ ਦੀ ਜਗ੍ਹਾ ਕੈਂਪਰ ਵਾਟਰਕੁਲਰ ਫ੍ਰਿਜ ਆਦਿ ਦੀ ਵਰਤੋਂ ਹੋਣ ਲੱਗ ਪਈ ਮਸ਼ੀਨੀਕਰਨ ਆਉਣ ਕਰਕੇ ਤਰਖਾਣਾਂ ਅਤੇ ਹੋਰ ਜਿਹੜੇ ਕਿੱਤੇ ਕਾਰ ਕਿੱਤੇ ਸੀਗੇ ਉਹਨਾਂ ਦਾ ਜੋ ਕਿੱਤਾ ਹੈ ਉਹ ਘੱਟ ਗਿਆ ਹੈ ਮੰਡੀ ਬਜ਼ਾਰ ਵਿੱਚ ਜੇ ਉਹ ਵਸਤੂਆਂ ਮਿਲਦੀਆਂ ਹਨ ਜਿਵੇਂ ਸਟੀਲ ਦੇ ਭਾਂਡੇ ਅਤੇ ਹੋਰ ਜੋ ਨਵੇਂ ਤੋਂ ਨਵਾਂ ਜਿਹੜਾ ਪਲਾਸਟਿਕ ਦੇ ਬਰਤਨ ਆਉਣ ਲੱਗ ਗਏ ਉਹਨਾਂ ਨੇ ਮਿੱਟੀ ਦੇ ਭਾਂਡੇ ਅਤੇ ਹੋਰ ਵਸਤੂਆਂ ਨੂੰ ਪਿਛੋ ਪਛਾੜ ਦਿੱਤਾ ਹੈ